ਹੈਲੋ ਹਾਂਜੀ ਮਾਸਟਰ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਮਾਸਟਰ ਜੀ ਪਛਾਣਿਆ ਨਹੀਂ ਮੈਂ ਸਨੀ ਇਵਕਲੇਵ ਤੋਂ ਬੋਲ਼ ਰਹੀ ਹਾਂ ਤੁਹਾਨੂੰ ਇੰਨੇ ਦਿਨ ਤੋਂ ਫੋਨ ਕਰ ਰਹੀ ਹਾਂ ਸੂਟ ਲੈ ਜੋ ਸੂਟ ਲੈ ਜੋ ਤੁਸੀਂ ਲੈ ਕੇ ਨਹੀਂ ਜਾਂਦੇ ਹਾਂਜੀ ਹਾਂਜੀ ਪਛਾਣ ਲਿਆ ਇੰਨੇ ਸੂਟ ਸਿਲਵਾਏ ਤੁਹਾਡੇ ਤੋਂ ਤੁਸੀਂ ਭੁੱਲ ਜਾਂਦੇ ਹੋ ਅੱਛਾ ਜੀ ਅੱਛਾ ਅੱਛਾ ਠੀਕ ਹੈ ਚਲੋ ਕੋਈ ਨਹੀਂ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਚਲੋ ਤੁਸੀਂ ਕੱਲ੍ਹ ਆਉਗੇ ਫਿਰ ਮੈਂ ਇੱਕ ਦੋ ਕੱਪੜੇ ਸਿਲਵਾਣੇ ਹੈ ਐਕਚੁਲੀ ਨਾ ਸਿਸਟਰ ਦੀ ਮੈਰਿਜ ਹੈ ਹਾਂ ਅਤੇ ਅਤੇ ਮੈਂ ਨਾ ਇੱਕ ਇੱਕ ਤਾਂ ਮੈਂ ਉਸਦੀ ਸਾੜੀ ਬਣਵਾਉਣੀ ਹੈ ਲੈਸ ਵਗੈਰਾ ਲਗਵਾਉਣੀ ਹੈ ਉਸ 'ਤੇ ਅਤੇ ਇੱਕ ਸ਼ਰਾਰਾ ਬਣਵਾਉਣਾ ਹੈ ਬਣਾ ਦੋਂਗੇ ਨਾ ਤੁਸੀਂ ਕਿੰਨਾਂ ਕੱਪੜਾ ਲੱਗੇਗਾ ਉਹਦੇ ਲਈ ਪੰਜ ਹਾਂਜੀ ਹਾਂਜੀ ਪੰਜ ਕੁ 'ਚ ਬਣ ਜੇਗਾ ਅਤੇ ਲੈਸ ਅਤੇ ਲਾਈਨਿੰਗ ਤੁਸੀਂ ਖੁਦ ਲੈ ਕੇ ਆਓਂਗੇ ਜਾਂ ਮੈਂ ਆਪਣਾ ਮਤਲਬ ਲੈ ਕਿ ਦੇਵਾਂ ਕਿੱਦਾਂ ਕਰਨਾ ਹਾਂ ਫਿਰ ਮੈਂ ਉਹ ਲੈਸ ਫਿਰ ਲਿਆ ਕੇ ਦੇ ਦਾਂਗੀ ਤੁਸੀਂ ਲਾਈਨਿੰਗ ਲੈ ਲਿਓ ਆਪਣੇ ਅਕੋਡਿੰਗ ਹੈ ਨਾ ਕੱਪੜਾ ਅਤੇ ਹਾਂਜੀ ਅੱਛਾ ਜੀ ਅੱਛਾ ਅਤੇ ਇੱਕ ਚੀਜ਼ ਹੋਰ ਪੁੱਛਣੀ ਸੀ ਤੁਸੀਂ ਦੂਸਰੇ ਸਲੀਵਲੈੱਸ ਬਲਾਉਜ਼ ਬਣਵਾਉਣਾ ਉਹ ਬਣ ਜੇਗਾ ਨਾ ਚਲੋ ਠੀਕ ਹੈ ਅਤੇ ਇੱਕ ਨਾ ਬੇਟੀ ਦਾ ਵੀ ਬਣਾਉਣਾ ਉਹਦਾ ਇੱਕ ਲਹਿੰਗਾ ਬਣਵਾਉਣਾ ਅਤੇ ਇੱਕ ਸੇਮ ਜੋ ਮੈਂ ਆਪਣਾ ਸੂਟ ਬਣਵਾਉਣਾ ਨਾ ਸੇਮ ਉਹ ਹੀ ਕੱਪੜਾ ਲੈਸ ਵਗੈਰਾ ਸੇਮ ਹੀ ਲੈ ਆਉਂਗੀ ਉਹਦਾ ਕਿੰਨੇ ਮੀਟਰ ਕੱਪੜਾ ਲੱਗੇਗਾ ਹਾਂਜੀ ਅੱਠ ਕੁ ਸਾਲ ਦੀ ਹੈ ਬੇਟੀ ਅੱਛਾ ਚਲੋ ਚਲੋ ਫਿਰ ਤੁਸੀਂ ਕੱਲ੍ਹ ਕਿੰਨੇ ਵਜੇ ਆਉਂਗੇ ਕਿੰਨੇ ਕੁ ਵਜੇ ਆਉਂਗੇ ਤੁਸੀਂ ਛੇ ਕੁ ਵਜੇ ਆ ਜਿਓ ਛੇ ਵਜੇ ਮੈਂ ਆ ਜਾਂਦੀ ਹਾਂ ਘਰ ਅਤੇ ਫਿਰ ਮੈਂ ਕੱਪੜਾ ਸਾਰਾ ਲੈ ਆਊਂਗੀ ਅੱਜ ਜਾ ਕੇ ਤੁਸੀਂ ਕੱਲ੍ਹ ਲੈ ਜਿਓ ਹੈ ਨਾ ਕੱਪੜੇ ਹਾਂਜੀ ਚਲੋ ਠੀਕ ਹੈ ਮਾਸਟਰ ਜੀ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ